ਸਤਿ ਸ਼੍ਰੀ ਅਕਾਲ ਜੀ

ਹਾਂਜੀ ਜ਼ਰੂਰ ਮੈਂ ਤੁਹਾਨੂੰ ਨਦੀਆਂ ਬਾਰੇ ਜ਼ਰੂਰ ਦੱਸ ਸਕਦੀ ਹਾਂ ਪੰਜਾਬ ਵਿੱਚੋਂ ਗੁਜਰਨ ਵਾਲੀ ਮੁੱਖ ਨਦੀਆਂ ਨੇ ਸਤਲੁਜ ਰਾਵੀ ਬਿਆਸ ਘੱਗਰ ਅਤੇ ਜਿਹਲਮ ਇਹੀ ਜਿਹੜੀ ਚਾਰ ਪੰਜ ਨਦੀਆਂ ਨੇ ਨਾ ਇਹ ਸਾਡੇ ਪੰਜਾਬ ਦੀ ਮੁੱਖ ਨਦੀਆਂ ਨੇ ਹਾਂਜੀ ਜਿਹੜੀ ਆਪਣੀ ਹੈਗੀ ਨਾ ਸਤਲੁਜ ਨਦੀ ਇਹ ਪੰਜਾਬ ਦੇ ਪੱਛਮੀ ਹਿੱਸਿਆਂ 'ਚੋਂ ਗੁਜ਼ਰਦੀ ਹੈਗੀ ਹੈ ਠੀਕ ਹੈ ਅਤੇ ਜਿਹੜੀ ਇਹ ਨਦੀ ਹੈਗੀ ਹੈ ਨਾ ਇਹ ਹਿਮਾਚਲ ਪ੍ਰਦੇਸ਼ ਤੋਂ ਨਿਕਲ ਕੇ ਪੰਜਾਬ ਵਿੱਚ ਐਂਟਰੀ ਕਰਦੀ ਹੈ ਫਿਰ ਉਸ ਤੋਂ ਬਾਅਦ ਇਹ ਫਿਰੋਜ਼ਪੁਰ ਤੋਂ ਹੁੰਦੀ ਹੁੰਦੀ ਫਰੀਦਕੋਟ ਅਤੇ ਮੁਕਤਸਰ ਸਾਹਿਬ ਜ਼ਿਲ੍ਹਾ ਵਿੱਚੋਂ ਗੁਜਰਦੀ ਹੈ ਠੀਕ ਹੈ ਫਿਰੋਜ਼ਪੁਰ ਫਰੀਦਕੋਟ ਫਿਰ ਮੁਕਤਸਰ ਆ ਕੇ ਗੁਜ਼ਰਦੀ ਹੈਗੀ ਇਹ ਉਹਨਾਂ ਜ਼ਿਲ੍ਹਿਆਂ ਵਿੱਚੋਂ ਹਾਂਜੀ ਰਾਵੀ ਨਦੀ ਜਿਹੜੀ ਹੈਗੀ ਹੈ ਨਾ ਆਪਣੀ ਇਹ ਪੰਜਾਬ ਦੇ ਉੱਤਰੀ ਹਿੱਸੇ ਵਿੱਚੋਂ ਹੋ ਕੇ ਗੁਜ਼ਰਦੀ ਹੈਗੀ ਹੈ ਅਤੇ ਜਿਹੜੀ ਰਾਵੀ ਨਦੀ ਹੈਗੀ ਹੈ ਇਹ ਜੰਮੂ ਕਸ਼ਮੀਰ ਵਿੱਚੋਂ ਨਿਕਲ ਕੇ ਪੰਜਾਬ ਵਿੱਚ ਐਂਟਰੀ ਕਰਦੀ ਹੈ ਅਤੇ ਫਿਰ ਗੁਰਦਾਸਪੁਰ ਆ ਆ ਕੇ ਰੁਕਦੀ ਹੈ ਅਤੇ ਗੁਰਦਾਸਪੁਰ ਤੋਂ ਪਠਾਨਕੋਟ ਫਿਰ ਪਠਾਨਕੋਟ ਤੋਂ ਹੋ ਕੇ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਗੁਜਰਦੀ ਹੈਗੀ ਹੈ ਇਹ ਹਾਂਜੀ ਬਿਆਸ ਨਦੀ ਹੈ ਨਾ ਜਿਹੜੀ ਇਹ ਹੈਗੀ ਹੈ ਪੰਜਾਬ ਦੇ ਮੱਧ ਹਿੱਸੇ ਵਿੱਚੋਂ ਗੁਜਰਦੀ ਹੈਗੀ ਹੈ ਠੀਕ ਹੈ ਅਤੇ ਇਹ ਨਦੀ ਜਿਹੜੀ ਹੈਗੀ ਹਿਮਾਚਲ ਪ੍ਰਦੇਸ਼ ਤੋਂ ਨਿਕਲ ਕੇ ਪੰਜਾਬ ਵਿੱਚ ਐਂਟਰੀ ਕਰਦੀ ਹੈ ਅਤੇ ਫਿਰ ਹੁਸ਼ਿਆਰਪੁਰ ਕਪੂਰਥਲਾ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਹੋ ਕੇ ਗੁਜ਼ਰਦੀ ਇਹ ਹਾਂਜੀ ਜਿਹੜੀ ਘੱਗਰ ਨਦੀ ਹੈਗੀ ਹੈ ਨਾ ਇਹ ਪੰਜਾਬ ਦੇ ਦੱਖਣੀ ਹਿੱਸੇ 'ਚੋਂ ਗੁਜ਼ਰਦੀ ਹੈ ਅਤੇ ਜਿਹੜੀ ਨਦੀ ਹੈਗੀ ਹੈ ਫਿਰ ਹਰਿਆਣਾ ਹਰਿਆਣਾ 'ਚੋਂ ਨਿਕਲ ਕੇ ਪੰਜਾਬ ਵਿੱਚ ਆ ਵੜਦੀ ਹੈਗੀ ਹੈ ਅਤੇ ਫਿਰ ਪਟਿਆਲਾ ਸੰਗਰੂਰ ਅਤੇ ਫਿਰ ਮਾਨਸਾ ਜ਼ਿਲ੍ਹੇ ਵਿੱਚ ਹੋ ਕੇ ਗੁਜ਼ਰਦੀ ਹੈ ਠੀਕ ਹੈ ਜੀ ਹਾਂਜੀ ਜਿਹੜੀ ਜਿਹਲਮ ਨਦੀ ਹੈਗੀ ਹੈ ਨਾ ਇਹ ਪੰਜਾਬ ਦੇ ਨਾ ਉੱਤਰੀ ਹਿੱਸੇ 'ਚ ਹੋ ਕੇ ਗੁਜ਼ਰਦੀ ਹੈ ਅਤੇ ਇਹ ਨਦੀ ਸਿਰਫ ਕਸ਼ਮੀਰ ਜਿਹੜੀ ਘਾਟੀਆਂ ਨੇ ਨਾ ਕਸ਼ਮੀਰ ਦੀਆਂ ਅਤੇ ਉਹਨਾਂ ਵਿੱਚੋਂ ਗਾਹਟੀਆਂ ਵਿੱਚੋਂ ਹੀ ਗੁਜ਼ਰ ਕੇ ਇਹ ਪੰਜਾਬ ਵਿੱਚ ਐਂਟਰ ਕਰਦੀ ਹੈ ਹਾਂਜੀ ਸਾਨੂੰ ਵੀ ਬਹੁਤ ਵਧੀਆ ਲੱਗਿਆ ਵੀ ਤੁਹਾਡੇ ਨਾਲ ਗੱਲ ਕਰਕੇ ਅਤੇ ਤੁਹਾਡਾ ਪੰਜਾਬ ਵਿੱਚ ਬਹੁਤ ਹੀ ਖੁੱਲ੍ਹੇ ਦਿਲ ਨਾਲ ਸਵਾਗਤ ਹੈਗਾ ਅਤੇ ਅਸੀਂ ਹਮੇਸ਼ਾ ਮਤਲਬ ਸਾਰਿਆਂ ਦਾ ਸਵਾਗਤ ਹੀ ਕਰਦੇ ਹਾਂ ਪੰਜਾਬ ਵਿੱਚ ਜਿਹੜੇ ਵੀ ਸਾਡੇ ਹੈ ਨਾ ਮਹਿਮਾਨ ਤੁਸੀਂ ਵੀ ਸਾਡੇ ਮਹਿਮਾਨ ਹੋ ਅਤੇ ਤੁਹਾਨੂੰ ਕ ਕੋਈ ਵੀ ਜਾਣਕਾਰੀ ਜੇ ਹੋਏ ਨਾ ਲੈਣੀ ਹੋਵੇ ਸਾਡੇ ਤੋਂ ਲੈ ਸਕਦੇ ਤੁਸੀਂ ਕਦੇ ਵੀ ਕੋਲ ਕਰ ਸਕਦੇ ਹੋ ਜੇ ਮੈਂ ਨਹੀਂ ਫ੍ਰੀ ਹੋਵਾਂਗਾ ਅਤੇ ਮੈਂ ਆਪਦੇ ਉਹਨੂੰ ਕਹਿ ਦਵਾਂਗਾ ਪੀਏ ਨੂੰ ਵੀ ਉਹ ਫੋਨ ਚੱਕ ਲਿਆ ਕਰੋ ਫੇਰ ਉਹ ਮੈਨੂੰ ਦੱਸ ਦਿਆ ਕਰੇਗਾ ਅਤੇ ਮੀਡੀਆ ਨਾਲ ਤਾਂ ਸਾਡੀ ਤੋਂ ਪਹਿਲਾਂ ਤੋਂ ਵੀ ਕਾਫੀ ਬਣਦੀ ਹੈ ਵੀ ਸਾਡਾ ਕੰਮ ਹੀ ਮੀਡੀਆ ਵਾਲਾ ਹੈਗਾ ਠੀਕ ਹੈ ਜੀ ਤੁਸੀਂ ਸਰ ਕਿੱਥੇ ਤੁਹਾਡੀ ਸਰਵਿਸ ਦਾ ਟੈਮ ਕਿੰਨਾ ਕੁ ਹੁੰਦਾ ਸਾਨੂੰ ਦੱਸੋ ਕੁਝ ਆਪਣੇ ਬਾਰੇ ਵੀ ਹਾਂਜੀ ਠੀਕ ਹੈ ਅਤੇ ਤੁਸੀਂ ਇਹ ਫੋਨ ਕੋਲ ਹੁਣ ਟੀਵੀ 'ਤੇ ਚੈਨਲਾਂ 'ਤੇ ਵੀ ਚਲਾਉਂਗੇ ਤੁਸੀਂ ਪੰਜਾਬ ਟਾਈਮਸ 'ਚ ਅੱਛਾ ਲੋਂਚ ਕਰੋਗੇ ਹੈ ਨਾ ਤੁਸੀਂ ਅੱਛਾ ਤੁਸੀਂ ਸਾਰੀ ਨਦੀਆਂ ਦਾ ਤਾਂ ਹੀ ਮੇਰੇ ਕੋਲ ਡੇਟਾ ਹੈ ਨਾ ਤੁਸੀਂ ਲਿਆ ਹਾਂ ਕਿਉਂਕਿ ਸਿੰਚਾਈ ਕਰਨ ਵਿੱਚ ਤਾਂ ਹੈ ਨਾ ਪਾਣੀ ਹੈ ਨਾ ਇਹਨਾਂ ਤਾ ਹੋਣੀ ਚਾਹੀਦੀ ਹੈ ਜਿਵੇਂ ਆਮ ਜਨਤਾ ਨੂੰ ਵੀ ਪਤਾ ਹੋਵੇ ਹੈ ਨਾ ਕਿਹੜੀ ਕਿਹੜੀ ਨਦੀ ਕਿੱਥੋਂ ਹੋ ਕੇ ਗੁਜ਼ਰਦੀ ਹੈ ਤਾਂ ਬਹੁਤ ਹੀ ਚੰਗਾ ਗੱਲ ਹੈਗਾ ਇਹ ਤਾਂ ਵਧੀਆ ਹੀ ਹੈਗਾ ਫਿਰ ਤਾਂ

ਹਾਂਜੀ ਅਤੇ ਮੈਂ ਤੁਹਾਨੂੰ ਇੱਕ ਹੋਰ ਰਾਏ ਦੇਣਾ ਚਾਹੁੰਦੀ ਹਾਂ ਇਸ ਬਾਰੇ ਵੀ ਤੁਸੀਂ ਇਹ ਨਾ ਮਤਲਬ ਜਨਤਾ ਨੂੰ ਖੋਲ੍ਹ ਕੇ ਦੱਸਿਆ ਕਰੋ ਵੀ ਹੈ ਨਾ ਨਦੀਆਂ ਬਾਰੇ ਅਤੇ ਉਹਨਾਂ ਨੂੰ ਵੀ ਆਮ ਜਨਤਾ ਨੂੰ ਵੀ ਵਿਚਾਰੀ ਨੂੰ ਪਤਾ ਹੋਵੇ ਸਿੰਚਾਈ ਬਾਰੇ ਉਹਨਾਂ ਨੂੰ ਵਿਚਾਰਿਆਂ ਨੂੰ ਥੋੜ੍ਹੀ ਹੈਲਪ ਹੋ ਸਕੇ ਇਸ ਕੰਮ ਵਿੱਚ ਨੋਲੇਜ ਹੋਣੀ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਅਤੇ ਕੋਈ ਵੀ ਜਾਣਕਾਰੀ ਹੋਵੇ ਤੁਸੀਂ ਸਾਨੂੰ ਮਤਲਬ ਕੋਲ ਕਰ ਸਕਦੇ ਹੋ ਲੈਣੀ ਹੋਵੇ ਤਾਂ ਧੰਨਵਾਦ ਜੀ ਹਾਂ